ਵਹਿਮ ਭਰਮ ਤੋਂ ਸਾਨੂੰ ਵੈਸੇ ਤਾਂ ਅੱਜ ਕੱਲ੍ਹ ਕੋਈ ਵਹਿਮ ਨਹੀਂ ਕਰਦਾ ਪਰ ਵਹਿਮ ਭਰਮ ਪਹਿਲੇ ਜ਼ਮਾਨਿਆਂ ਵਿੱਚ ਬਹੁਤ ਜ਼ਿਆਦਾ ਮੰਨਿਆ ਜਾਂਦਾ ਸੀ ਜਿਵੇਂ ਕਿ ਜਿਵੇਂ ਕਿ ਸਾਡੀ ਦਾਦੀ ਪੜਦਾਦੀ ਵੇਲੇ ਬਹੁਤ ਜ਼ਿਆਦਾ ਵਹਿਮ ਕੀਤਾ ਜਾਂਦਾ ਸੀ ਅਤੇ ਹੁਣ ਉਸ ਟਾਇਮ 'ਤੇ ਸ਼ਨੀਵਾਰ ਨੂੰ ਮਾਂਹ ਦੀ ਦਾਲ ਘਰ ਨਹੀਂ ਬਣਦੀ ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦਾ ਵਹਿਮ ਹੈ ਮਾਂਹ ਦੀ ਦਾਲ ਸ਼ਨੀਵਾਰ ਨੂੰ ਖਾਣੀ ਚੰਗੀ ਨਹੀਂ ਸਮਝਦੇ ਮੰਗਲਵਾਰ ਨੂੰ ਮੰਗਲਵਾਨ ਨੂੰ ਲੋਕ ਵਾਲ ਨਹੀਂ ਧੋਂਦੇ ਨਾਖੁਨ ਨਹੀਂ ਕੱਟਦੇ ਅਤੇ ਵੀਰਵਾਰ ਨੂੰ ਵੀ ਲੋਕ ਬਹੁਤ ਜ਼ਿਆਦਾ ਵਹਿਮ ਕਰਦੇ ਹਨ ਜਿਵੇਂ ਕਿ ਵਾਲ ਨਹੀਂ ਧੋਂਦੇ ਨਾਖੁਨ ਨਹੀਂ ਕੱਟਨੇ ਕੱਪੜੇ ਨਹੀਂ ਧੋਣੇ ਫਲਾਣਾ ਵਹਿਮ ਲੋਕਾਂ ਦੇ ਬਹੁਤ ਜ਼ਿਆਦਾ ਮਨ ਵਿੱਚ ਪਹਿਲੇ ਭਰੇ ਹੋਏ ਸੀ ਕਿਸੇ ਦੇ ਘਰ ਖਾਣ ਤੋਂ ਪਹਿਲਾਂ ਵਹਿਮ ਆਉਂਦਾ ਸੀ ਲੋਕ ਭਲਾ ਤਾਂ ਘੱਟ ਬੁਰਾ ਬਹੁਤ ਸੋਚਦੇ ਸੀ ਬਹੁਤ ਜ਼ਿਆਦਾ ਵਹਿਮ ਆਉਂਦਾ ਸੀ ਕਿਸੇ ਦੇ ਘਰ ਖਾਣ ਪੀਣ ਤੋਂ ਵੀ ਟੂਨੇ ਟੱਪੇ ਤੋਂ ਬਹੁਤ ਵਹਿਮ ਆਉਂਦਾ ਸੀ ਸਾਨੂੰ ਲੋਕਾਂ ਤੋਂ ਅੱਜ ਕੱਲ੍ਹ ਬਚ ਕੇ ਰਹਿਣਾ ਚਾਹੀਦਾ ਹੈ ਕੋਈ ਆਪਣਾ ਨਹੀਂ